ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਇਹ ਸਿਰਫ਼ ਇੱਕ ਨਾਚ ਨਹੀਂ ਸਗੋਂ ਪੰਜਾਬੀ ਜੀਵਨ ਸ਼ੈਲੀ ਖੁਸ਼ੀ ਅਤੇ ਜੋਸ਼ ਦਾ ਪ੍ਰਤੀਕ ਹੈ ਭੰਗੜਾ ਪੰਜਾਬ ਦੇ ਲੋਕਾਂ ਲਈ ਦਿਲਾਂ ਵਿੱਚ ਵਸਿਆ ਹੋਇਆ ਹੈ ਅਤੇ ਇਹਨਾਂ ਇਥੋਂ ਦੇ ਸੱਭਿਆਚਾਰਿਕ ਦਾ ਅਣਖੀਕਰਨ ਅੰਗ ਹੈ ਭੰਗੜੇ ਦੀ ਸ਼ੁਰੂਆਤ ਪੰਜਾਬ ਦੇ ਕਿਸਾਨਾਂ ਦੁਆਰਾ ਹੋਈ ਸੀ ਜਦੋਂ ਫ਼ਸਲ ਪੱਕ ਜਾਂਦੀ ਸੀ ਤਾਂ ਕਿਸਾਨ ਆਪਣੀ ਖੁਸ਼ੀ ਜਾਹਰ ਕਰਨ ਲਈ ਇਕੱਠੇ ਹੋ ਕੇ ਨੱਚਦੇ ਸਨ ਇਹ ਨਾਚ ਉਹਨਾਂ ਦੀ ਮਿਹਨਤ ਅਤੇ ਫ਼ਸਲ ਦੇ ਚੰਗੇ ਹੋਣ ਦੀ ਖੁਸ਼ੀ ਦਾ ਪ੍ਰਗਟਾਵਾ ਸੀ ਭੰਗ ਭੰਗੜਾ ਪੰਜਾਬੀ ਲੋਕਾਂ ਦੇ ਜੀਵਨ ਵਿੱਚ ਪੰਜਾਬੀ ਅਤੇ ਉਤਸ਼ਾਹ ਭਰਨ ਦਾ ਇੱਕ ਤਰੀਕਾ ਸੀ ਇਸ ਵਿੱਚ ਢੋਲ ਦੀ ਤਾਲ 'ਤੇ ਨੱਚਿਆ ਜਾਂਦਾ ਸੀ ਨੱਚਿਆ ਜਾਂਦਾ ਸੀ ਜੋ ਕਿ ਪੰਜਾਬੀ ਲੋਕਾਂ ਦੇ ਲੋਕਾਂ ਨੂੰ ਦਿਲਾਂ ਵਿੱਚ ਜੋਸ਼ ਨਾਲ ਭਰ ਦਿੰਦਾ ਸ ਹੈ ਭੰਗੜਾ ਪੰਜਾਬੀ ਲੋਕਾਂ ਦੀ ਏਕਤਾ ਅਤੇ ਭਾਈਚਾਰੇ ਦਾ ਵੀ ਪ੍ਰਤੀਕ ਹੈ ਇਹ ਲੋਕਾਂ ਨੂੰ ਇਕੱਠੇ ਲਿਆਉਂਦਾ ਹੈ ਅਤੇ ਉਹਨਾਂ ਵਿੱਚ ਇੱਕ ਜੁੱਟਤਾ ਦੀ ਭਾਵਨਾ ਪੈਦਾ ਕਰਦਾ ਹੈ